ਮੈਨੂੰ ਬਾਗਬਾਨੀ ਸ਼ੁਰੂ ਕਰਨ ਲਈ ਸਾਡੇ ਪੰਜਾਬ ਦਾ ਜਿਹੜਾ ਮਾਹੌਲ ਹੈ ਉਹਨੇ ਬਹੁਤ ਪ੍ਰੇਰਿਤ ਕੀਤਾ ਸਾਡੇ ਪੰਜਾਬ ਦੇ ਵਿੱਚ ਸ਼ੁਰੂ 'ਚ ਹੀ ਬਾਗ ਲਗਾਏ ਜਾਂਦੇ ਨੇ ਜਿਸ ਤਰ੍ਹਾਂ ਸਾਡੇ ਇਕ ਆਮ ਤੌਰ 'ਤੇ ਨਾ ਇੱਧਰ ਅਬੋਹਰ ਵਾਲੇ ਪਾਸੇ ਸਾਡੇ ਉਹ ਜਿਹੜਾ ਹੈਗਾ ਇੱਕ ਸੰਤਰਾ ਇੱਕ ਤਰ੍ਹਾਂ ਦਾ ਸੰਤਰਾ ਤਾਂ ਨਹੀਂ ਕਹਿੰਦੇ ਖੈਰ ਕਿੰਨੂ ਕਿੰਨੂ ਦਾ ਫ ਫਲ ਬਹੁਤ ਲਾਇਆ ਜਾਂਦਾ ਕਿੰਨੂ ਸੰਤਰੇ ਤੋਂ ਜ਼ਿਆਦਾ ਮਿੱਠਾ ਪੈਦਾ ਹੋਣ ਲੱਗ ਗਿਆ ਕਿੰਨੂ ਸੰਤਰੇ ਤੋਂ ਹੈ ਸੰਤਰੇ ਦੀ ਜਾਤੀ ਦਾ ਪਰੰਤੂ ਕਿਨੂੰ ਮਿੱਠਾ ਬਹੁਤ ਹੋਣ ਲੱਗਾ ਪੰਜਾਬ ਦੇ ਵਿੱਚ ਕਿਨੂੰ ਸੰਤਰੇ ਨੂੰ ਫੇਲ ਕਰ ਗਿਆ ਇੰਨਾਂ ਜ਼ਿਆਦਾ ਬਾਗਾਂ ਦੇ ਬਾਗ ਲੱਗ ਚੁੱਕੇ ਨੇ ਉਸੇ ਨੂੰ ਉਸੇ ਨੂੰ ਦੇਖ ਕੇ ਅਸੀਂ ਵੀ ਬਾਗ ਲਗਾਇਆ ਇੱਥੇ ਇਹ ਬਾਗ ਆ ਜਿਹੜਾ ਸਾਡੇ ਰੋਜ਼ ਦਾ ਡੇਲੀ ਦਾ ਚਾਰ ਗੱਡੀਆਂ ਕਿੰਨੂਆਂ ਦੀਆਂ ਅਸੀਂ ਭਰ ਕੇ ਬਾਹਰ ਦਿੱਲੀ ਵੀ ਭੇਜਦੇ ਹਾਂ ਅਤੇ ਹਰਿਆਣੇ 'ਚ ਵੀ ਭੇਜਦੇ ਹਾਂ ਭਲਵਾਣੀ ਜਾਂਦੀਆਂ ਨੇ ਅਤੇ ਨਾਲ ਅਸੀਂ ਸਾਡੇ ਜਾਮਣਾਂ ਦਾ ਬਾਗ ਲਾਇਆ ਇੱਕ ਜਾਮਣਾਂ ਸਾਡੇ ਪੰਜਾਬ 'ਚ ਹੀ ਵਿਕ ਜਾਂਦੀਆਂ ਨੇ ਇਸ ਤੋਂ ਇਲਾਵਾ ਸਾਡੇ ਅਮਰੂਦਾਂ ਦਾ ਬਾਗ ਵੀ ਹੈ ਇਹ ਇਹ ਸਾਰਾ ਜਿਹੜਾ ਕੀਤਾ ਸੀ ਸਾਡੇ ਕੋਲ ਡੇਢ ਕ ਸੌ ਕਿੱਲਾ ਜ਼ਮੀਨ ਦਾ ਹੈ ਉਹ ਡੇਢ ਸੌ ਕਿਲੇ ਜ਼ਮੀਨ ਦੇ ਵਿੱਚ ਅਸੀਂ ਸਾਰੇ ਤਰ੍ਹਾਂ ਦੇ ਫਲ ਲੱਗ ਲਗਭਗ ਲਗਾਏ ਹੋਏ ਨੇ ਇਹ ਫਲ ਪੂਰੇ ਸੀਜ਼ਨਲ ਮਤਲਬ ਮੌਸਮ ਦੇ ਮੌਸਮ ਦੇ ਮੁਤਾਬਿਕ ਹੀ ਸਾਡੇ ਮਤਲਬ ਫਲ ਹੁੰਦਾ ਉਹਦੇ ਨਾਲ ਫਿਰ ਸਾਡੇ ਕੋਲ ਲਗਭਗ ਤਿੰਨ ਕੁ ਸੌ ਬੰਦਾ ਅਸੀਂ ਕੰਮ ਕਰਦਾ ਉਹ ਫਲਾਂ ਨੂੰ ਚੱਕਣ ਵਾਸਤੇ ਚਕਾਉਣ ਵਾਸਤੇ ਫਲਾਂ ਦੀ ਛੰਗਾਈ ਪੌਦਿਆ ਦੀ ਛੰਗਾਈ ਅਤੇ ਇਹ ਬਾਗਬਾਨੀ ਸਾਨੂੰ ਇ ਇਹਦੇ ਨਾਲ ਇੱਕ ਇੱਕ ਫਾਇਦਾ ਹੋਰ ਵੀ ਹੈ ਜਿਹੜੀ ਸਾਡੀ ਧਰਤੀ ਹੈ ਉਹ ਖੁਰਦੀ ਨਹੀਂ ਜਿਵੇਂ ਮੀਂਹ ਆਉਂਦੇ ਨੇ ਹੜ੍ਹ ਆਉਂਦੇ ਨੇ ਤਾਂ ਆਮ ਕਰਕੇ ਜਿਹੜੀ ਧਰਤੀ ਹੁੰਦੀ ਹੈ ਛੋਟੀਆਂ ਫਸਲਾਂ ਵਾਲੀ ਉਹ ਖੁਰਣ ਲੱਗ ਜਾਂਦੀ ਹੈ ਪਰ ਜਿੱਥੇ ਬਾਗ ਲੱਗੇ ਹੁੰਦੇ ਉੱਥੇ ਨਹੀਂ ਇਹ ਖੁਰਦੀ ਉੱਥੇ ਮਜ਼ਬੂਤ ਹੋ ਜਾਂਦੀ ਹੈ ਕਿਉਂਕਿ ਬ ਜਿੱਥੇ ਜਿੱਥੇ ਇਹ ਤੁਸੀਂ ਦੋ ਸੌ ਕਿੱਲਾ ਤਿੰਨ ਸੋ ਕਿਲਾ ਤਾਂ ਉਹਦੇ ਨਾਲ ਆਸੇ ਪਾਸੇ ਦਾ ਪੰਜ ਚਾਰ ਸੌ ਕਿਲਾ ਹੋਰ ਵੀ ਹੈ ਜਿਹੜਾ ਉਹ ਖੁਰਣ ਤੋਂ ਬਚ ਜਾਂਦਾ ਜਿਹੜੀ ਪਹਿਲਾਂ ਅੱਜ ਤੋਂ ਸੌ ਸਾਲ ਪਹਿਲਾਂ ਧਰਤੀ ਖੁਰਣ ਦੀ ਆਮ ਕਰਕੇ ਆਪਾਂ ਕਹਿੰਦੇ ਕਹਿ ਸਕਦੇ ਸੀਗੇ ਵੀ ਧਰਤੀ ਖੁਰਦੀ ਹੈ ਉਹ ਉਹ ਖੁਰਣ ਤੋਂ ਬਚ ਜਾਂਦੀ ਇਹਦੇ ਨਾਲ ਇਸ ਤਰ੍ਹਾਂ ਅਸੀਂ ਬਾਗਾਂ ਦੇ ਵਿੱਚ ਪੰਜਾਬ ਜਿਹੜਾ ਹੈਗਾ ਉਹ ਕਾਫੀ ਮਤਲਬ ਫੇਮਸ ਹੈ ਬੋ ਕਾਫੀ ਮਸ਼ਹੂਰ ਹੈ ਬਾਗਾਂ ਦੇ ਨਾਮ ਨਾਲ ਕਈ ਸਾਡੇ ਏਰੀਏ ਜਾਣੇ ਜਾਂਦੇ ਨੇ ਜਿਵੇਂ ਸਾਡਾ ਕਪੂਰਥਲਾ ਪਟਿਆਲਾ ਹੈ ਇਹ ਇਹਨੂੰ ਬਾਗਾਂ ਦਾ ਸ਼ਹਿਰ ਕਿਹਾ ਜਾਂਦਾ ਪਟਿਆਲੇ ਨੂੰ ਅਤੇ ਕਪੂਰਥਲੇ ਨੂੰ ਫਰੀਦਕੋਟ ਦੇ ਵਿੱਚ ਬਾਗ ਬਹੁਤ ਲਗਾਏ ਜਾਂਦੇ ਨੇ ਇਸ ਤਰ੍ਹਾਂ ਅਬੋਹਰ ਫਾਜ਼ਿਲਕਾ 'ਚ ਬਾਗ ਬਹੁਤ ਲੱਗਦੇ ਨੇ ਪਰੰਤੂ ਅਸੀਂ ਮਾਨਸਾ ਜ਼ਿਲ੍ਹੇ 'ਚ ਬਹੁਤ ਬਾਗ ਲਗਾਏ ਨੇ ਹੁਣ ਇਹ ਇਹਨਾਂ ਬਾਗਾਂ ਦੇ ਨਾਲ ਹੀ ਸਾਨੂੰ ਦੂਜੇ ਦੇਸ਼ਾਂ ਦੇ ਵਿੱਚ ਵੀ ਚਾਹੇ ਸਾਨੂੰ ਮਤਲਬ ਸਾਡੀ ਕਾਫੀ ਪਹਿਚਾਣ ਹੋਣ ਲੱਗ ਗਈ ਧੰਨਵਾਦ